ਪਹਿਲਾਂ ਤਾਂ ਮੈਂ ਉਸ ਵਿਅਕਤੀ ਨੂੰ ਫਸਟ ਏਡ ਦੇਵਾਂਗੀ ਜਿਸ ਜਗ੍ਹਾ 'ਤੇ ਸੱਪ ਨੇ ਉਸ ਨੂੰ ਡੰਗ ਮਾਰਿਆ ਹੈ ਉਸਨੂੰ ਮੈਂ ਕਸ ਕੇ ਬੰਨ ਦੇਵਾਂਗੀ ਤਾਂ ਕਿ ਜਿਹੜਾ ਜ਼ਹਿਰ ਹੈ ਉਹ ਉਸਦੇ ਪੂਰੇ ਸਰੀਰ ਵਿੱਚ ਨਾ ਫੈਲ ਜਾਵੇ ਫਿਰ ਮੈਂ ਬੰਨੀ ਹੋਈ ਜਗ੍ਹਾ 'ਤੇ ਜਿਸ ਜਗ੍ਹਾ 'ਤੇ ਉਸਨੂੰ ਸੱਪ ਨੇ ਡੰਗ ਮਾਰਿਆ ਹੋਏਗਾ ਉਸ 'ਤੇ ਮੈਂ ਕੱਟ ਲਗਾਵਾਂਗੀ ਕਿਉਂਕਿ ਜਿਹੜਾ ਜ਼ਹਿਰ ਇਸ ਦੇ ਅੰਦਰ ਨਾ ਫੈਲ ਜਾਵੇ ਜ਼ਹਿਰ ਜਿਹੜਾ ਹੈ ਉਹ ਖੂਨ ਰਾਹੀਂ ਥੋੜ੍ਹਾ ਵਹਿ ਕੇ ਬਾਹਰ ਆ ਜਾਵੇ ਫਿਰ ਮੈਂ ਉਸਨੂੰ ਨਜ਼ਦੀਕੀ ਹੋਸਪੀਟਲ ਵਿੱਚ ਲੈ ਕੇ ਜਾਵਾਂਗੀ ਫਿਰ ਮੈਂ ਉਸਨੂੰ ਡੋਕਟਰਾਂ ਨੂੰ ਦਿਖਾਵਾਂਗੀ ਫਿਰ ਮੈਂ ਉਸਦੇ ਘਰ ਇਨਫੋਰਮ ਕਰਾਂਗੀ ਵੀ ਇਸ ਤਰ੍ਹਾਂ ਤੁਹਾਡੇ ਘਰ ਦੇ ਜੀ ਨੂੰ ਸੱਪ ਨੇ ਡੰਗ ਮਾਰ ਲਿਆ ਹੈ ਇਸ ਤਰ੍ਹਾਂ ਮੈਂ ਉਸਦੀ ਜਾਨ ਬਚਾ ਸਕਦੀ ਹਾਂ ਧੰਨਵਾਦ